ਅੱਜ ਕੱਲ੍ਹ ਪਿੰਡਾਂ ਦੀ ਨੌਜਵਾਨ ਪੀੜ੍ਹੀ ਨੂੰ ਜੀਵਨ ਸਾਥੀ ਪ੍ਰਾਪਤ ਕਰਨ ਦੇ ਵਿੱਚ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਿੰਡਾਂ ਦੇ ਵਿੱਚ ਲੋਕ ਬੇਸ਼ੱਕ ਪੜ੍ਹਦੇ ਹਨ ਅਤੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਚੰਗੀ ਟਿਊਸ਼ਨ ਨਹੀਂ ਮਿਲਦੀ ਅਤੇ ਉਹ ਵਿੱਦਿਆ ਤੋਂ ਵਾਂਝੇ ਰਹਿ ਜਾਂਦੇ ਹਨ ਸ਼ਹਿਰਾਂ ਦੇ ਵਿੱਚ ਲੋਕ ਕਿਉਂ ਪਸੰਦ ਰਹਿਣਾ ਪਸੰਦ ਕਰਦੇ ਹਨ ਇਸ ਲਈ ਸ਼ਹਿਰ ਦੇ ਵਿੱਚ ਹਰ ਤਰ੍ਹਾਂ ਦੀ ਟਿਊਸ਼ਨ ਮਿਲਦੀ ਹੈ ਅਤੇ ਚੰਗੇ ਪਰਿਵਾਰਾਂ ਨਾਲ ਮੁਲਾਕਾਤਾਂ ਹੁੰਦੀਆਂ ਹਨ ਅਤੇ ਚੰ ਸ਼ਹਿਰਾਂ ਦੇ ਵਿੱਚ ਚੰਗੇ ਸਕੂਲ ਕਾਲਜ ਮਿਲਦੇ ਹਨ ਇਸ ਲਈ ਹੀ ਬੱਚੇ ਪੜ੍ਹ ਕੇ ਚੰਗੀ ਵਿੱਦਿਆ ਹਾਸਲ ਕਰਕੇ ਵਧੀਆ ਪੜ੍ਹਾਈਆਂ ਪ੍ਰਾਪਤ ਕਰਦੇ ਹਨ ਅਤੇ ਜੋ ਪਿੰਡਾਂ ਦੇ ਲੋਕ ਹਨ ਉਹ ਸ਼ਹਿਰਾਂ ਵਿੱਚ ਰਹਿਣਾ ਇਸ ਲਈ ਪਸੰਦ ਕਰਦੇ ਹਨ ਕਿਉਂਕਿ ਉਹਨਾਂ ਨੂੰ ਜੀਵਨ ਸਾਥੀ ਸ਼ਹਿਰਾਂ ਦੇ ਵਿੱਚ ਵਧੀਆ ਪੜ੍ਹੇ ਲਿਖੇ ਮਿਲ ਜਾਂਦੇ ਹਨ ਅਤੇ ਸ਼ਹਿਰਾਂ ਦੇ ਵਿੱਚ ਰਹਿਣ ਸਹਿਣ ਵੀ ਵਧੀਆ ਮਿਲ ਜਾਂਦਾ ਹੈ